ਜਦੋਂ ਅਸੀਂ ਖਾਣਾ ਬਣਾਉਂਦੇ ਹਾਂ ਤਾਂ ਸਭ ਤੋਂ ਪਹਿਲੀ ਸਾਵਧਾਨੀ ਤਾਂ ਇਹ ਹੈ ਕਿ ਜੋ ਰਾਅ ਮਟੀਰੀਅਲ ਹੈ ਉਹਨੂੰ ਚੰਗੀ ਤਰ੍ਹਾਂ ਸਾਫ ਕੀਤਾ ਜਾਵੇ ਦੂਸਰਾ ਜੇ ਤੁਸੀਂ ਕੋਈ ਸ਼ਾਰਪ ਇੰਸਟਰੂਮੈਂਟ ਜਿਵੇਂ ਛੁਰੀ ਯੂਜ ਕਰ ਰਹੇ ਹੋ ਤਾਂ ਉਹਨੂੰ ਪ੍ਰੋਪਰ ਤਰੀਕੇ ਨਾਲ ਯੂਜ ਕਰਨਾ ਸੇਫਟੀ ਦੇ ਨਾਲ ਤੀਸਰਾ ਜੇ ਤੁਸੀਂ ਗੈਸ ਦੇ ਉੱਤੇ ਕੰਮ ਕਰ ਰਹੇ ਹੋ ਜਾਂ ਕੋਈ ਬਿਜਲੀ ਉਪਕਰਨ ਦਾ ਕੰਮ ਕਰ ਰਹੇ ਹੋ ਤਾਂ ਉਹਨੂੰ ਵੀ ਸਾਵਧਾਨੀ ਦੇ ਨਾਲ ਵਰਤਣਾ ਹੈ ਖਾਣੇ ਦੇ ਵਿੱਚ ਨਮਕ ਫੇਰ ਉਹ ਜਲਣਾ ਨਹੀਂ ਚਾਹੀਦਾ ਨਮਕ ਜ਼ਿਆਦਾ ਨਹੀਂ ਹੋਣਾ ਚਾਹੀਦਾ ਅਤੇ ਫਲੇਵਰਜ ਜਿਹੜੇ ਨੇ ਉਹ ਉੱਭਰ ਕੇ ਆਉਣੇ ਚਾਹੀਦੇ ਹਨ